ਹਾਂਜੀ ਸਤਿ ਸ਼੍ਰੀ ਅਕਾਲ ਜੀ ਅਕਾਲ ਅਕੈਡਮੀ ਬਾਸਰਕੇ ਤੋਂ ਗੱਲ ਕਰ ਰਹੇ ਹੋ ਸਰ ਮੈਂ ਅਕਾਲਰੂਪ ਸਿੰਘ ਦਾ ਪਿਤਾ ਗੱਲ ਕਰ ਰਿਹਾ ਇਸ ਤਰ੍ਹਾਂ ਸੀ ਕਿ ਅਸੀਂ ਨਾ ਕਿਸੇ ਦੂਸਰੀ ਸਟੇਟ ਦੇ ਵਿੱਚ ਵਿਆਹ 'ਤੇ ਜਾਣਾ ਸੀ ਅਤੇ ਬੱਚੇ ਨੂੰ ਇੱਕ ਹਫਤੇ ਦੀ ਛੁੱਟੀ ਚਾਹੀਦੀ ਸੀ ਇਸ ਤਰ੍ਹਾਂ ਹੈ ਨਾ ਸਾਡਾ ਵਿਆਹ ਥੋੜ੍ਹਾ ਦੂਰ ਹੈਗਾ ਅਤੇ ਸਾਨੂੰ ਜਾਂਦਿਆਂ ਵੀ ਇੱਕ ਦੋ ਦਿਨ ਲੱਗ ਜਾਣੇ ਆ ਇਸ ਕਰਕੇ ਸਾਨੂੰ ਇੱਕ ਹਫਤੇ ਦੀ ਛੁੱਟੀ ਜਿਹੜੀ ਚਾਹੀਦੀ ਸੀਗੀ ਵਿਆਹ ਅਸੀਂ ਚੰਗੀ ਤਰ੍ਹਾਂ ਵੇਖ ਆਈਏ ਉਹ ਤਾਂ ਹੈਗਾ ਹੀ ਹੈ ਅਸੀਂ ਇਸ ਤਰ੍ਹਾਂ ਕਰਾਂਗੇ ਨਾ ਔਨਲਾਈਨ ਕਲਾਸਾਂ ਜਿਹੜੀਆਂ ਆ ਉਹ ਬੱਚੇ ਦੀਆਂ ਅਟੈਂਡ ਨਾਲ ਦੀ ਨਾਲ ਅਸੀਂ ਕਰਵਾਈ ਜਾਵਾਂਗੇ ਅਸੀਂ ਟਰੇਨ ਦੇ ਵਿੱਚ ਹੀ ਜਾਣਾ ਹੈ ਅਤੇ ਅਸੀਂ ਨਾਲ ਦੀ ਨਾਲ ਇਹਦੀਆਂ ਕਲਾਸਾਂ ਜਿਹੜੀਆਂ ਉਹ ਲਗਾਈ ਜਾਵਾਂਗੇ ਹਾਂਜੀ ਉਹ ਤਾਂ ਹੈਗਾ ਹੀ ਹੈ ਥੋੜ੍ਹਾ ਐਡਸਟਮੈਂਟ ਤਾਂ ਕਰਨੀ ਪੈਣੀ ਹੈ ਉਹ ਐਕਚੁਲੀ ਇਹਦੇ ਮਾਮਾ ਨੇ ਹਾਂਜੀ ਉਹ ਤਾਂ ਹੈਗਾ ਹੀ ਹੈ ਬਾਕੀ ਇਹ ਕਿ ਬੱਚੇ ਦਾ ਚਲੋ ਅਸੀਂ ਨਾਲ ਦੀ ਨਾਲ ਕੰਮ ਕਰਾਵਾਂਗੇ ਰਾਤ ਵੇਲੇ ਇਹਦੀ ਕਲਾਸ ਲਗਾਇਆ ਕਰਾਂਗੇ ਆਪ ਬੈਠ ਕੇ ਅਤੇ ਸਾਨੂੰ ਕਿਰਪਾ ਕਰਕੇ ਜਿਹੜੀ ਇੱਕ ਹਫ਼ਤੇ ਦੀ ਛੁੱਟੀ ਦਿੱਤੀ ਜਾਵੇ ਠੀਕ ਹੈ ਸਰ ਮੈਂ ਫੇਰ ਕੱਲ੍ਹ ਨਾ ਸਕੂਲ ਆਵਾਂਗਾ ਫਿਰ ਬੈਠ ਕੇ ਆਪਾਂ ਗੱਲ ਧੰਨਵਾਦ ਸਰ ਬਹੁਤ ਬਹੁਤ ਥੈਂਕ ਯੂ